ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸ਼ਿਲਪਕਾਰੀ ਬਹੁਤ ਵਧੀਆ ਤਰੀਕੇ ਨਾਲ ਸਿਖਾ ਸਕਦੇ ਹਾਂ ਅੱਜ ਕੱਲ ਦੇ ਬੱਚਿਆਂ ਨੂੰ ਸ਼ਿਲਪਕਾਰੀ ਦੇ ਵਿੱਚ ਬਹੁਤ ਜਿਆਦਾ ਇੰਟਰਸਟ ਹੈ ਪੜ੍ਹਾਈ ਨਾਲੋਂ ਜ਼ਿਆਦਾ ਵੀ ਬੱਚੇ ਇਸ ਚੀਜ਼ ਵਿੱਚ ਰੁਚੀ ਰੱਖਦੇ ਹਨ ਹਾਂ ਮੇਰੇ ਕੋਲ ਕਲਾ ਤੇ ਸ਼ਿਲਪਕਾਰੀ ਨਾਲ ਸੰਬੰਧਿਤ ਬਚਪਨ ਦੀਆਂ ਬਹੁਤ ਯਾਦਾਂ ਹਨ ਜਿਵੇਂ ਕਿ ਗੁੱਡੀਆਂ ਬਣਾਉਣਾ ਮੀਂਹ ਵਿੱਚ ਕਿਸ਼ਤੀਆਂ ਬਣਾਉਣਾ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਗੁੱਡੀਆ ਨਾਲ ਖੇਲਦੀ ਹੁੰਦੀ ਸੀ ਮੇਰੀ ਮਾ ਮੇਰੀ ਮਾਂ ਜੀ ਮੈਨੂੰ ਗੁੱਡੀਆਂ ਦੇ ਲਈ ਕੱਪੜੇ ਬਣਾ ਕੇ ਦਿੰਦੇ ਸਨ ਤੇ ਮੈਂ ਗੁੱਡੀਆਂ ਦੇ ਰੋਜ਼ ਹੀ ਕੱਪੜੇ ਨਵੇਂ ਨਵੇਂ ਪਵਾਂਦੀ ਸੀ ਮੈਂ ਤੇ ਮੇਰੀ ਸਹੇਲੀ ਦੋਨੇ ਮਿਲ ਕੇ ਬਹੁਤ ਖੇਲਦੇ ਹੁੰਦੇ ਸੀ ਕਦੇ ਮੈਂ ਉਸ ਗੁੱਡੀ ਦਾ ਸ਼ਿੰਗਾਰ ਕਰਦੀ ਸੀ ਤੇ ਕਦੀ ਉਹ ਮੇਰੀ ਗੁੱਡੀ ਦਾ ਸ਼ਿੰਗਾਰ ਕਰਦੀ ਸੀ ਜਦੋਂ ਵੀ ਮੀਂਹ ਆਉਂਦਾ ਸੀ ਤਾਂ ਅਸੀਂ ਕਾਗਜ਼ ਦੀਆਂ ਕਿਸ਼ਤੀਆਂ ਬਣਾਉਂਦੇ ਸੀ ਤੇ ਫਿਰ ਸਾਰੇ ਜਣੇ ਰਲ ਕੇ ਕਿਸ਼ਤੀਆਂ ਦਾ ਮੈਚ ਵੀ ਲਗਾਉਂਦੇ ਸੀ ਕਿਹੜੀ ਕਿਸ਼ਤੀ ਪਹਿਲਾਂ ਜਿੱਤੀ ਤੇ ਕਿਹੜੀ ਕਿਸ਼ਤੀ ਬਾਅਦ ਵਿੱਚ ਜਿੱਤਦੀ ਹੈ ਇਸ ਤਰ੍ਹਾਂ ਆਪਾਂ ਸਕੂਲ ਦੇ ਵਿਦਿਆਰਥੀਆਂ ਨੂੰ ਕਲਾ ਤੇ ਸ਼ਿਲਪਕਾਰੀ ਵੀ ਸਿਖਾ ਸਕਦੇ ਹਾਂ